ਸਾਡੇ ਘਰ ਵਿੱਚ ਬਿਜਲੀ ਦਸ ਘੰਟੇ ਆਉਂਦੀ ਹੈ ਇਹਦਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਹੁਣ ਮੌਸਮਾਂ ਦੇ ਬਦਲਣ ਨਾਲ ਵੀ ਬ ਬਿਜਲੀ ਪ੍ਰਾਪਤ ਹੋਣ ਵਿੱਚ ਕਾਫੀ ਸਮਾਂ ਲੱਗਦਾ ਹੈ ਅਤੇ ਵੱਖ ਵੱਖ ਮੌਸਮਾਂ ਦੌਰਾਨ ਇਸ ਦੀ ਖਪਤ ਘੱਟ ਅਤੇ ਵੱਧ ਹੋ ਜਾਂਦੀ ਹੈ ਜਿਵੇਂ ਕਿ ਫਸਲਾਂ ਦੇ ਮੌਸਮ ਵਿੱਚ ਜ਼ਿਆਦਾ ਜ਼ਿਆਦਾ ਬਿਜਲੀ ਜਾਂਦੀ ਹੈ ਅਤੇ ਹੋਰਾਂ ਸੂਬਿਆਂ ਨੂੰ ਅਤੇ ਪੰਜਾਬ ਦੇ ਕਾਫੀ ਕਿਸਾਨਾਂ ਨੂੰ ਇਹ ਬਿਜਲੀ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਇਸ ਨਾਲ ਸਾਡੀ ਜ਼ਿੰਦਗੀ ਕਾਫੀ ਪ੍ਰਭਾਵਿਤ ਹੁੰਦੀ ਹੈ ਸਾ ਅੱਜ ਕਿਉਂਕਿ ਅੱਜ ਕੱਲ੍ਹ ਹਰ ਕੰਮ ਬਿਜਲੀ ਉੱਪਰ ਡਿਪੈਂਡ ਹੋ ਗਿਆ ਹੈ ਭਾਵੇਂ ਉਹ ਕੱਪੜੇ ਕੱਪੜੇ ਧੋਣ ਦਾ ਕੰਮ ਹੋਵੇ ਚਾਹੇ ਉਹ ਕੋਈ ਵੀ ਕੰਮ ਹੋਵੇ ਇਸ ਨਾਲ ਸਾਡੇ ਪੰਜਾ ਕਾਫੀ ਉਪਕਰਨ ਚਲਦੇ ਹਨ ਜਿਵੇਂ ਕਿ ਵਾਸ਼ਿੰਗ ਮਸ਼ੀਨ ਅਤੇ ਇਸ ਤੋਂ ਇਲਾਵਾ ਪ੍ਰੈਸ ਪ੍ਰੈਸ ਹੋ ਗਈ ਜੇ ਕੱਪੜੇ ਪ੍ਰੈਸ ਕਰਨ ਵਾਲੀ ਪ੍ਰੈਸ ਵੀ ਇਸ ਨਾਲ ਪ੍ਰਭਾਵਿਤ ਹੁੰਦੀ ਹੈ ਅਤੇ ਕਾ ਕਾਫੀ ਤਰੀਕਿਆਂ ਨਾਲ ਇਹ ਅਸੀਂ ਪੰਜਾਬੀ ਲੋਕ ਪ੍ਰਭਾਵਿਤ ਹੁੰਦੇ ਹਾਂ